ਅਸੀਂ ਕੱਪੜੇ ਧੋਣ ਲਈ ਬਹੁਤ ਹੀ ਤਰ੍ਹਾਂ ਦੇ ਵੱਖ ਵੱਖ ਥਾਵਾਂ ਦੀ ਸਥਿਤੀਆਂ ਨੂੰ ਦੇਖਦੇ ਹਾਂ ਜਿਵੇਂ ਕਿ ਅਸੀਂ ਕੱਪੜੇ ਧੋਣ ਲਈ ਸਭ ਤੋਂ ਪਹਿਲਾਂ ਚੰਗੀ ਬਾਲਟੀ ਜੋ ਕਿ ਵੀ ਲਿਬੜੀ ਨਾ ਹੋਵੇ ਤਾਂ ਜੋ ਸਾਡੇ ਕੱਪੜੇ ਖਰਾਬ ਨਾ ਹੋ ਸਕਣ ਉਹਨੂੰ ਚੰਗੀ ਤਰ੍ਹਾਂ ਸਾਫ ਕਰ ਲੈਂਦੇ ਹਾਂ ਫਿਰ ਜੋ ਵੀ ਸਾਰੇ ਘਰ ਦੇ ਜਿੰਨੇ ਵੀ ਕੱਪੜੇ ਹੁੰਦੇ ਹਨ ਉਹਨਾਂ ਨੂੰ ਇੱਕ ਥਾਂ ਇਕੱਠਾ ਕਰਕੇ ਸਭ ਤੋਂ ਪਹਿਲਾਂ ਕੋਲ ਸਾਬਣ ਸਾਬਣ ਰੱਖ ਲੈਂਦੇ ਹਾਂ ਅਤੇ ਸਰਫ ਵੀ ਯੂਜ ਕਰਦੇ ਹਾਂ ਅਸੀਂ ਕੱਪੜਿਆਂ ਨੂੰ ਬੱਠਲ ਵਿੱਚ ਧੋਂਦੇ ਹਾਂ ਬੱਠਲ ਵਿੱਚ ਇੱਕ ਦੋ ਕੱਪੜੇ ਪਾ ਕੇ ਉਹ 'ਚ ਸਰਫ ਪਾ ਕੇ ਉਹਨਾਂ ਨੂੰ ਚੰਗੀ ਤਰ੍ਹਾਂ ਮਸਲਦੇ ਹਾਂ ਤਾਂ ਕਿ ਜੋ ਕੱਪੜਿਆਂ 'ਤੇ ਲੱਗੀ ਕੋਈ ਵੀ ਮੈਲ ਗੰਦਗੀ ਦੂਰ ਹੋ ਸਕੇ ਇਹ ਬਹੁਤ ਹੀ ਧਿਆਨ ਵਾਲੀ ਗੱਲ ਦੇਣ ਵਾਲੀ ਗੱਲ ਹੈ ਕਿ ਜਦੋਂ ਅਸੀਂ ਕੱਪੜੇ ਧੋਂਦੇ ਹਾਂ ਕੱਪੜਿਆਂ ਨੂੰ ਬਹੁਤ ਜ਼ਿਆਦਾ ਰਗੜਣਾ ਵੀ ਨਹੀਂ ਚਾਹੀਦਾ ਜੋ ਕਿ ਕੱਪੜੇ ਫਟ ਨਾ ਜਾਣ ਅਤੇ ਉਹ ਉਸ ਵਿੱਚ ਕੋਈ ਵੀ ਚੁੰਝ ਵਾਲੀ ਚੀਜ਼ ਜਾਂ ਉਸ ਵਿੱਚ ਕੋਈ ਧਾਗਾ ਧਾਗਾ ਨਾ ਖਿੱਚਿਆ ਜਾ ਸਕਦਾ ਹੋਏ ਅਤੇ ਇਹਨੂੰ ਅਸੀਂ ਜਦੋਂ ਧੋ ਲੈਂਦੇ ਹਾਂ ਤਾਂ ਅਸੀਂ ਆਪਣੇ ਘਰ ਦੀ ਕੰਧ 'ਤੇ ਲੱਗੀ ਇੱਕ ਤਾਰ ਲੋਹੇ ਦੀ ਤਾਰ ਬੰਨ੍ਹ ਰੱਖੀ ਹੈ ਉਹਨੂੰ ਉਹਦੇ 'ਤੇ ਸੁਕਣੇ ਪਾ ਦਿੰਦੇ ਹਾਂ ਅਤੇ ਉਹ ਤਾਰ ਨੂੰ ਹਮੇਸ਼ਾ ਅਸੀਂ ਵਧੀਆ ਰੱਖਦੇ ਹਾਂ ਅਤੇ ਕੋਈ ਦਿੱਕਤ ਨਹੀਂ ਪੈਂਦੀ ਅਤੇ ਗਰਮੀਆਂ ਵੇਲੇ ਇਸਨੂੰ ਤਾਰ 'ਤੇ ਸੁੱਕਣੇ ਪਾ ਦਿੰਦੇ ਹਾਂ ਅਤੇ ਸਰਦੀਆਂ ਵੇਲੇ ਅਸੀਂ ਇਸ ਨੂੰ ਚੰਗੀ ਤਰ੍ਹਾਂ ਵਾਸ਼ਿੰਗ ਮਸ਼ੀਨ ਵਿੱਚ ਸੁਕਾ ਕੇ ਫੇਰ ਇਹਨੂੰ ਸੁੱਕਣੇ ਪਾਉਂਦੇ ਹਾਂ ਅਤੇ ਇੱਕ ਚੀਜ਼ ਦਾ ਹੋਰ ਵੀ ਧਿਆਨ ਰੱਖਣਾ ਪੈਂਦਾ ਹੈ ਜਦੋਂ ਸੁੱਕਣੇ ਪਾਉਣ ਵਾਲੇ ਵੇਲੇ ਕੋਈ ਨੁਕੀਲੀ ਚੀਜ਼ ਨਾ ਲੱਗ ਸਕੇ ਇਸ ਨੂੰ ਇਸ ਲਈ ਵਧੀਆ ਤਰੀਕੇ ਨਾਲ ਹੀ ਸੁਕਾਉਂਦੇ ਹਾਂ